ਮੈਂ ਸਿਲਾਈ ਦਾ ਕੰਮ ਕਰਦੀ ਹਾਂ ਮੈਂ ਸਟੀਚਿੰਗ ਦਾ ਬਹੁਤ ਵਧੀਆ ਕੰਮ ਕਰ ਲੈਂਦੀ ਸਟੀਚਿੰਗ ਦਾ ਜ ਪੰਜਾਬੀ ਸੂਟ ਹੋ ਗਿਆ ਪੁੱਚਾ ਸਲਰਟ ਚੌੜੀ ਮੂਹਰੀ ਵਾਲੀ ਸਲਵਾਰ ਅੱਜ ਕੱਲ੍ਹ ਟਰੈਂਡ ਹੈ ਬਹੁਤ ਜ਼ਿਆਦਾ ਉਹ ਵੀ ਸੀਅ ਲੈਂਦੀ ਪਲਾਜ਼ੋ ਸੂਟ ਲੋਂਗ ਕਮੀਜ਼ ਸਟਰੇਟ ਕਮੀਜ਼ ਸਿੱਧਾ ਚਾਕਾਂ ਵਾਲਾ ਲੋਂਗ ਉਹ ਵੀ ਸੀਅ ਲੈਂਦੀ ਨੈਰੋ ਕੱਟ ਸੂਟ ਅੱਜ ਕੱਲ੍ਹ ਬਹੁਤ ਟਰੈਂਡ ਹੈ ਉਹਦਾ ਫਰੋਕ ਟਾਇਪ ਉੱਪਰ ਵਲ਼ ਪਾ ਕੇ ਉਹ ਉਹ ਵੀ ਬਹੁਤ ਵਧੀਆ ਬਣਾ ਲੈਂਦੀ ਮੈਂ ਅਤੇ ਜਿਸ ਤਰ੍ਹਾਂ ਇੱਕ ਧੋਤੀ ਸਲਵਾਰ ਉੱਚਾ ਕਮੀਜ਼ ਉਹ ਵੀ ਬਹੁਤ ਵਧੀਆ ਕਢਣਾ ਡੀਜਾਈਨਰ ਸੂਟ ਪਾਈਪਿੰਗ ਵਗੈਰਾ ਕਢ ਕੇ ਬੈਕ ਗਲੇ 'ਤੇ ਹਲਕੀ ਹਲਕੀ ਪਾਈਪਿੰਗ ਲਗਾ ਕੇ ਫਿਰ ਪਿੱਛੇ ਫੂੰਦੇ ਫਾਂਦੇ ਲਗਾ ਕੇ ਜਿਸ ਤਰ੍ਹਾਂ ਨਵੇਂ ਡੀਜਾਈਨ ਦਾ ਸੂਟ ਹੁੰਦਾ ਕਿ ਤੁਸੀਂ ਰੇਡੀਮੇਟ ਤੋਂ ਵੀ ਜ਼ਿਆਦਾ ਵਧੀਆ ਸੀਅ ਕੇ ਮੈਂ ਪੁਆ ਦਿੰਦੀ ਲੋਕਾਂ ਨੂੰ ਕਿ ਲੋਕ ਕਹਿੰਦੇ ਹਾਏ ਰੇਡੀਮੇਟ ਤੋਂ ਵੀ ਵਧੀਆ ਸੂਟ ਹੈ ਹਰੇਕ ਤਰ੍ਹਾਂ ਦਾ ਕਮੀਜ਼ ਪਜਾਮਾ ਉਹ ਵੀ ਸੀਅ ਲੈਂਦੀ ਛੋਟੇ ਛੋਟੇ ਬੱਚਿਆਂ ਦੇ ਨਿੱਕੇ ਨਿੱਕੇ ਲਹਿੰਗਾ ਚੋਲੀ ਹਰੇਕ ਤਰ੍ਹਾਂ ਦੀ ਸਟੀਚਿੰਗ ਕਰ ਲੈਂਦੀ ਮੈਂ ਸਿਲਾਈ 'ਚ ਕੋਈ ਇਹੋ ਜਿਹੀ ਨਹੀਂ ਹੈ ਜਿਸ ਤਰ੍ਹਾਂ ਕਿ ਫਰੋਕ ਹੈ ਫਰੋਕ ਨੂੰ ਫਰਿੱਲਾਂ ਲਾ ਕੇ ਰੇਡੀਮੈਟ ਦੀ ਤਰ੍ਹਾਂ ਬਣਾ ਕੇ ਉਹ ਵੀ ਮੈਂ ਤਿਆਰ ਕਰ ਦਿੰਦੀ ਉਹ ਵੀ ਰੇਡੀਮੇਟ ਦੁਕਾਨਾਂ ਵਾਲੇ ਵੀ ਮੇਰੇ ਤੋਂ ਲੈ ਜਾਂਦੇ ਕਿ ਹਾਂ ਰੇਡੀਮੇਟ ਦੀ ਤਰ੍ਹਾਂ ਮੈਂ ਸੇਲ ਵੀ ਕਰ ਦਿੰਦੀ ਦੁਕਾਨਾਂ 'ਤੇ ਐਨਾ ਕਿ ਬਹੁਤ ਵਧੀਆ ਮੇਰਾ ਕੰਮ ਆ ਸਿਲਾਈ ਦਾ